ਅਠਾਰ੍ਹਾਂ ਅਪ੍ਰੈਲ ਦੋ ਹਜ਼ਾਰ ਚਾਰ ਪੱਚੀ ਅਗਸਤ ਦੋ ਹਜ਼ਾਰ ਇੱਕ ਸਤਾਈ ਜਨਵਰੀ ਦੋ ਹਜ਼ਾਰ ਛੇ ਪੰਜ ਮਾਰਚ ਉੱਨੀ ਸੌ ਛਿਆਸੀ ਚੌਦ੍ਹਾਂ ਨਵੰਬਰ ਉੱਨੀ ਸੌ ਨੱਬੇ